ਜਿਵੇਂ ਕਿ ਅੱਜ ਕੱਲ੍ਹ ਚੱਲਦੀਆਂ ਨੇ ਐਪਸ ਚਲਦੀਆਂ ਨੇ ਕੋਈ ਵੀ ਮੀਸ਼ੋ ਫਲਿਪਕਾਰਟ ਐਮਾਜ਼ੋਨ ਤਾਂ ਇਹਨਾਂ 'ਤੇ ਕੀ ਹੁੰਦਾ ਜਦੋਂ ਆਪਾਂ ਸਮਾਨ ਮੰਗਵਾਉਂਦੇ ਹਾਂ ਤਾਂ ਉਹ ਵਧੀਆ ਨਹੀਂ ਆਉਂਦਾ ਕਈ ਵਾਰ ਸਮਾਨ ਦੀ ਕੁਆਲਿਟੀ ਬਹੁਤ ਘਟੀਆ ਆ ਜਾਂਦੀ ਆ ਉਹਦਾ ਕਲਰ ਨਹੀਂ ਵਧੀਆ ਆਉਂਦਾ ਜਿਹਦੇ ਕਰਕੇ ਕਿ ਸਾਰੇ ਲੋਕ ਡਰਦੇ ਆ ਔਨਲਾਈਨ ਸਾਰਾ ਕੁਛ ਮੰਗਵਾਉਣ ਤੋਂ ਤਾਂ ਲੋਕ ਇਹ ਹੀ ਚੀਜ਼ ਸੋਚਦੇ ਕਿ ਇੱਥੋਂ ਹੀ ਲਿਆ ਜਾਵੇ ਦੁਕਾਨ ਤੋਂ ਜਿਵੇਂ ਕਿ ਪਿਛਲੀ ਵਾਰ ਮੈਂ ਆਪਣੇ ਲਈ ਕੋਈ ਕੱਪੜੇ ਮੰਗਵਾਏ ਆਨਲਾਈਨ ਜੋ ਕਿ ਜਵਾਂ ਹੀ ਬਹੁਤ ਗੰਦੇ ਕੁਆਲਿਟੀ ਦੇ ਆਏ ਉਹਨਾਂ ਦਾ ਨਾ ਹੀ ਰੰਗ ਵਧੀਆ ਸੀ ਨਾ ਹੀ ਉਹਨਾਂ ਦਾ ਕੋਈ ਸ਼ੋਪਿੰਗ ਆਪਾਂ ਕਹਿ ਸਕਦੇ ਹਾਂ ਵਧੀਆ ਹੁੰਦੀ ਆ ਉੱਥੋਂ ਦੀ ਉਹ ਬਿਲਕੁਲ ਹੀ ਬੇਕਾਰ ਸੀ ਜੋ ਕਿ ਬਾਅਦ 'ਚੋਂ ਵਾਪਸ ਵੀ ਨਹੀਂ ਹੋਏ ਅਤੇ ਮੇਰੇ ਪੈਸੇ ਵੀ ਜਿਹੜੇ ਕਿ ਸਾਰੇ ਖ਼ਰਾਬ ਚਲੇ ਗਏ ਨਾ ਹੀ ਉਹਨਾਂ ਨੇ ਪੈਸੇ ਵਾਪਸ ਭੇਜੇ ਅਤੇ ਨਾ ਹੀ ਉਹਨਾਂ ਨੇ ਆਪਣਾ ਸਮਾਨ ਵਾਪਸ ਲਿੱਤਾ ਜਿਸਦੇ ਕਰਕੇ ਕਿ ਮੈਨੂੰ ਬਹੁਤ ਨੁਕਸਾਨ ਹੋਇਆ ਤੇ ਹੁਣ ਮੈਂ ਇਹ ਹੀ ਸੋਚ ਲਿਆ ਕਿ ਅੱਗੇ ਤੋਂ ਮੈਂ ਕੁਛ ਵੀ ਨਹੀਂ ਮੰਗਵਾਵਾਂਗੀ ਉੱਥੋਂ ਤਾਂ ਕਿ ਮੇਰਾ ਅੱਗੇ ਜਾ ਕੇ ਕੋਈ ਨੁਕਸਾਨ ਨਾ ਹੋਵੇ ਅਤੇ ਮੈਂ ਲੋਕਾਂ ਨੂੰ ਵੀ ਇਹ ਹੀ ਸਲਾਹ ਦੇ ਰਹੀ ਹਾਂ ਹੁਣ ਕਿ ਕੋਈ ਵੀ ਸਮਾਨ ਆਨਲਾਈਨ ਨਹੀਂ ਮੰਗਵਾਉਣਾ ਚਾਹੀਦਾ ਜਿਹਦੇ ਨਾਲ ਕਿ ਲੋਕਾਂ ਨੂੰ ਭਵਿੱਖ ਵਿੱਚ ਕੋਈ ਵੀ ਪ੍ਰੋਬਲਮ ਆਵੇ ਕੋਈ ਦਿੱਕਤ ਆਵੇ ਅਤੇ ਉਹਨਾਂ ਦੇ ਪੈਸੇ ਵੀ ਵੇਸਟ ਹੋਣ ਅਤੇ ਕੋਈ ਜਿਹੜੇ ਉਹਨਾਂ ਨੇ ਸਮਾਨ ਮੰਗਵਾਇਆ ਉਹ ਵੀ ਕਿਸੇ ਕੰਮ ਦਾ ਨਾ ਹੋਵੇ ਕਿਉਂਕਿ ਮੈਂ ਤਿੰਨ ਚਾਰ ਵਾਰੀ ਮੇਰੇ ਨਾਲ ਇਹ ਚੀਜ਼ ਹੋ ਚੁੱਕੀ ਹੈ ਕਿ ਮੈਂ ਸਮਾਨ ਮੰਗਵਾਇਆ ਸੀ ਜੋ ਕਿ ਬਿਲਕੁਲ ਵਧੀਆ ਨਹੀਂ ਆਇਆ ਤਾਂ ਕਰਕੇ ਮੈਂ ਉਸ ਐਪ ਨੂੰ ਰੇਟਿੰਗ ਵੀ ਜੋ ਕੀ ਹੈ ਵਧੀਆ ਨਹੀਂ ਦਿੱਤੀ ਮੈਂ ਉਸ ਨੂੰ ਰੇਟਿੰਗ ਦੇਣਾ ਵੀ ਪਸੰਦ ਨਹੀਂ ਕਰਦੀ ਅਤੇ ਨਾ ਹੀ ਕਿਸੇ ਨੂੰ ਉਸ ਚੀਜ਼ ਤੋਂ ਰੇਟਿੰਗ ਦੇਣੀ ਚਾਹੀਦੀ ਹੈ ਕਿਉਂਕਿ ਉਹ ਐਪ ਬਹੁਤ ਹੀ ਬੇਕਾਰ ਹੈ